ਹਾਂਜੀ ਬਹੁਤ ਸਾਰੇ ਪਕਵਾਨ ਜਿਹੜੇ ਮੈਂ ਤਿਆਰ ਕਰ ਸਕਦੀ ਹਾਂ ਕਰਦੀ ਵੀ ਹਾਂ ਘਰ ਨੂੰ ਘਰਦਿਆਂ ਨੂੰ ਬਣਾ ਕੇ ਖਵਾਉਂਦੀ ਹਾਂ ਜਿਸ ਤਰ੍ਹਾਂ ਕਾਲੇ ਛੋਲੇ ਹੋ ਗਏ ਚਿੱਟੇ ਛੋਲੇ ਹੋ ਗਏ ਰਾਜਮਾਂਹ ਚਾਵਲ ਹੋ ਗਏ ਰਾਜਮਾਂਹ ਚਾਵਲ ਸਾਰੇ ਬੜੇ ਖੁਸ਼ ਹੋ ਕੇ ਖਾ ਲੈਂਦੇ ਹਨ ਸਾਰੇ ਖੁਸ਼ ਹੋ ਕੇ ਖਾ ਲੈਂਦੇ ਹਨ ਜਿਵੇਂ ਭਟੂਰੇ ਛੋਲੇ ਹੋ ਗਏ ਪੰਜਾਬ ਦੇ ਵੈਸੇ ਬੜੇ ਫੇਵਰੇਟ ਮੰਨੇ ਜਾਂਦੇ ਨੇ ਅਤੇ ਹੋਰ ਇਸ ਤਰ੍ਹਾਂ ਦੇ ਕਈ ਪਕਵਾਨ ਹਨ ਜਿਹੜੇ ਮੈਂ ਬਣਾ ਲੈਂਦੀ ਹਾਂ ਅਤੇ ਸਾਰਿਆਂ ਨੂੰ ਬਣਾ ਕੇ ਖਵਾਉਂਦੀ ਹਾਂ ਅਤੇ ਇਸ ਤੋਂ ਇਲਾਵਾ ਹੁਣ ਜਿਵੇਂ ਸਾਊਥ ਇੰਡੀਅਨ ਪਕਵਾਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਹਨ ਅਤੇ ਇਸ ਲਈ ਮੈਂ ਹੁਣ ਸਾਊਥ ਇੰਡੀਅਨ ਵੀ ਟਰਾਈ ਕਰ ਰਹੀ ਹਾਂ ਜਿਵੇਂ ਸਾਂਭਰ ਹੋ ਗਿਆ ਸਾਂਭਰ ਹੋ ਗਿਆ ਇਡਲੀ ਹੋ ਗਈ ਅਤੇ ਪੋਹਾ ਹੋ ਗਿਆ ਪੋਹੇ ਦੇ ਵਿੱਚ ਜਿਵੇਂ ਕਿ ਮੈਂ ਹੁਣ ਰੈਸਪੀ ਦੇਖ ਕੇ ਅਤੇ ਮੈਂ ਬਣਾਏ ਸੀ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਉਹਨੂੰ ਥੋੜ੍ਹਾ ਗਿੱਲਾ ਕਰਦੇ ਹਾਂ ਫਿਰ ਸੁਕ ਸੁਕਾਉਂਦੇ ਹਾਂ ਉਸ ਤੋਂ ਪਹਿਲਾਂ ਅਸੀਂ ਸਾਰੇ ਜਿਵੇਂ ਗਾਜਰ ਲੈ ਲਈ ਗੋਭੀ ਲੈ ਲਈ ਬੀਨਸ ਲੈ ਲਈਆਂ ਮਟਰਸ ਲੈ ਲਈਆਂ ਇਹ ਚੋਪ ਕਰਨ ਵਾਲੀਆਂ ਸਬਜ਼ੀਆਂ ਨੂੰ ਅਸੀਂ ਚੋਪ ਕਰਦੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਕਿ ਥੋੜ੍ਹੇ ਲੈ ਲੈਂਦੇ ਨਟਸ ਲੈ ਲੈਂਦੇ ਹਾਂ ਉਹਨਾਂ ਨੂੰ ਅਸੀਂ ਫਰਾਈ ਕਰਦੇ ਹਾਂ ਅਤੇ ਫਰਾਈ ਕਰਕੇ ਪਹਿਲਾਂ ਬਾਹਰ ਕੱਢਦੇ ਹਾਂ ਉਸ ਤੋਂ ਬਾਅਦ ਜਿਵੇਂ ਤੇਲ ਪਾ ਕੇ ਅਤੇ ਅਸੀਂ ਕੜੀ ਪੱਤਾ ਪਾ ਦਿੰਦੇ ਹਾਂ ਉਸ ਤੋਂ ਬਾਅਦ ਸਾਰੀਆਂ ਸਬਜ਼ੀਆਂ ਵਿੱਚ ਪਾ ਦਿੰਦੇ ਹਾਂ ਥੋੜ੍ਹੀ ਦੇਰ ਉਹਨੂੰ ਸਟੀਮ 'ਚ ਪੱਕਣ ਦਿੰਦੇ ਹਾਂ ਤਾਂ ਕਿ ਕੋਈ ਕੱਚੀਆਂ ਨਾ ਰਹਿ ਜਾਣ ਅਤੇ ਉਹ ਜਦੋਂ ਸਾਨੂੰ ਸਾਨੂੰ ਲੱਗਦਾ ਕਿ ਪੱਕ ਗਈਆਂ ਨੇ ਉਸ ਤੋਂ ਬਾਅਦ ਅਸੀਂ ਉਹਦੇ 'ਚ ਪੋਹਾ ਪਾ ਦਿੰਦੇ ਹਾਂ ਅਤੇ ਥੋੜ੍ਹੀ ਦੇਰ ਉਹਨੂੰ ਹਿਲਾਉਂਦੇ ਹਾਂ ਢੱਕ ਦਿੰਦੇ ਹਾਂ ਅਤੇ ਜਦੋਂ ਉਹ ਮਤਲਬ ਲੱਗਦਾ ਸਾਨੂੰ ਬਣ ਗਿਆ ਹੈ ਫਿਰ ਉਸ ਦੇ ਉੱਪਰ ਅਸੀਂ ਧਨੀਆ ਵਗੈਰਾ ਪਾ ਕੇ ਅਤੇ ਬੜੇ ਚੰਗੇ ਤਰੀਕੇ ਨਾਲ ਸਰਵ ਕਰ ਸਕਦੇ ਹਾਂ ਅਤੇ ਉਹ ਖਾਣ ਦੇ ਵਿੱਚ ਵੀ ਹੈਲਦੀ ਹੈ ਅਤੇ ਸਾਰਿਆਂ ਨੂੰ ਬੜੇ ਚੰਗੇ ਤਰੀਕੇ ਨਾਲ ਪਸੰਦ ਵੀ ਆਉਂਦਾ ਹੈ